ਜਦ ਬੱਚਾ ਜੰਮਦਾ ਹੈ ਅਤੇ ਉਸਦੇ ਜੰਮਣ ਦੌਰਾਨ ਹੀ ਉਸ ਦੇ ਮਾਂ ਬਾਪ ਤੈਅ ਕਰਦੇ ਹਨ ਕਿ ਉਸਨੂੰ ਕਿਸ ਦੀ ਗੁੜਤੀ ਦਿੱਤੀ ਜਾਵੇਗੀ ਇਹ ਗੁੜਤੀ ਵਿੱਚ ਬੱਚੇ ਨੂੰ ਉਸ ਬੰਦੇ ਦੁਬਾਰਾ ਸ਼ਹਿਦ ਚਟਾਇਆ ਜਾਂਦਾ ਹੈ ਇਹ ਰਸਮ ਹੁੰਦੀ ਹੈ ਦੂਜੀ ਰਸਮ ਇਹ ਹੁੰਦੀ ਹੈ ਕਿ ਉਸ ਦਾ ਦੋ ਤਿੰਨ ਦਿਨ ਬਾਅਦ ਉਸ ਨੂੰ ਨਵਾਉਣ ਦੀ ਰਸਮ ਕੀਤੀ ਜਾਂਦੀ ਹੈ ਬੱਚੇ ਨੂੰ ਨਵਾਇਆ ਜਾਂਦਾ ਹੈ ਅਤੇ ਉਸ ਉਸ ਇਸ ਰਸਮ ਤੋਂ ਬਾਅਦ ਬੱਚੇ ਦੀ ਨਾਮਕਰਨ ਦੀ ਰਸਮ ਕੀਤੀ ਜਾਂਦੀ ਹੈ ਇਸ ਵਿੱਚ ਨਾਮਕਰਨ ਮਤਲਬ ਕਿ ਬੱਚੇ ਦਾ ਟੇਵਾ ਬਣਵਾ ਕੇ ਉਸਦਾ ਪਹਿਲਾ ਅਕਸ਼ਰ ਕਢਾਇਆ ਜਾਂਦਾ ਹੈ ਅਤੇ ਮਾਂ ਬਾਪ ਦੁਆਰਾ ਪਹਿਲੇ ਅਕਸ਼ਰ ਤੋਂ ਹੀ ਉਸ ਬੱਚੇ ਦੇ ਨਾਮ ਦਾ ਨਿਰਧਾਰਣ ਕੀਤਾ ਜਾਂਦਾ ਹੈ ਲੇਕਿਨ ਅੱਜ ਕੱਲ੍ਹ ਤਾਂ ਲੋਕ ਪਹਿਲਾਂ ਹੀ ਨਾਮ ਸੋਚ ਕੇ ਰੱਖਦੇ ਹਨ ਪਰ ਅਗਰ ਰਸਮਾਂ ਰੀਤੀਆਂ ਰਿਵਾਜ਼ਾਂ ਬਾਰੇ ਦੇਖਿਆ ਜਾਵੇ ਤਾਂ ਇੱਕ ਬੜੀ ਇੰਪੋਰਟੈਂਟ ਅਤੇ ਬੜੀ ਜ਼ਰੂਰੀ ਰਸਮ ਹੈ ਅਤੇ ਇਸ ਤੋਂ ਬਾਅਦ ਤਮ ਬੱਚੇ ਦਾ ਧਮਾਣ ਕੀਤਾ ਜਾਂਦਾ ਹੈ ਇਹ ਬੜੀ ਵੱਡੀ ਰਸਮ ਹੁੰਦੀ ਹੈ ਜਿਸ ਵਿੱਚ ਬੱਚੇ ਦੇ ਮਾਂ ਪਿਓ ਇੱਕ ਵੱਡਾ ਫੰਕਸ਼ਨ ਕਰਦੇ ਹਨ ਜਿਸ ਵਿੱਚ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪੂਜਾ ਪਾਠ ਵਗੈਰਾ ਕੀਰਤਨ ਵਗੈਰਾ ਕਰਵਾਇਆ ਜਾਂਦਾ ਹੈ ਅਤੇ ਇਹ ਰਸਮ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿਉਂਕਿ ਬੱਚੇ ਦੀ ਜਨਮ ਦੀ ਖੁਸ਼ੀ ਵਿੱਚ ਇਹ ਮਨਾਈ ਜਾਂਦੀ ਹੈ ਇਸ ਤੋਂ ਬਾਅਦ ਬੱਚੇ ਦਾ ਜਨਮ ਦਿਨ ਇੱਕ ਸਾਲ ਬਾਅਦ ਮਨਾਇਆ ਜਾਂਦਾ ਹੈ